ਜੇਕਰ ਆਪਾਂ ਸੰਸਾਰ ਦੇ ਵਿਕਾਸਸ਼ੀਲਤਾ ਦੀ ਗੱਲ ਕਰੀਏ ਤਾਂ ਇਹ ਸੰਸਾਰ ਨੇ ਪਿਛਲੇ ਕੁਛ ਸਮੇਂ ਤੋਂ ਕਾਫੀ ਵਿਕਾਸ ਵਿਕਾਸ ਵਿਕਸਤ ਹੋਇਆ ਹੈ ਨੀ ਕੋਈ ਵੀ ਆਪਾਂ ਖੇਤਰ ਲੈ ਲਈਏ ਹਰ ਖੇਤਰ ਬਹੁਤ ਜ਼ਿਆਦਾ ਵਿਕਸਤ ਹੋ ਚੁੱਕਾ ਹੈ ਜੇਕਰ ਆਪਾਂ ਐਜੂਕੇਸ਼ਨ ਜਾਂ ਪੜ੍ਹਾਈ ਸੈਕਟਰ ਦੀ ਗੱਲ ਕਰੀਏ ਤਾਂ ਇਸ ਵਿੱਚ ਵੀ ਪਿਛਲੇ ਦਹਾਕਿਆਂ ਤੋਂ ਕਾਫੀ ਬਦਲਾਅ ਆ ਗਿਆ ਇਸ ਨੇ ਕਾਫੀ ਤਰੱਕੀ ਕਰ ਲਈ ਹੈ ਹੁਣ ਅਸੀਂ ਘਰ ਬੈਠੇ ਹੀ ਔਨਲਾਇਨ ਕਲਾਸਾਂ ਲਗਾ ਰਹੇ ਹਾਂ ਕਿਤੇ ਸਾਨੂੰ ਕੋਲਜ ਜਾਣਾ ਕੋਈ ਜ਼ਰੂਰੀ ਨਹੀਂ ਅਸੀਂ ਘਰ ਬੈਠ ਕੇ ਵੀ ਪੜ੍ਹ ਸਕਦੇ ਹਾਂ ਸਾਨੂੰ ਔਨਲਾਈਨ ਸੁਵਿਧਾ ਮਿਲ ਰਹੀ ਹੈ ਇਹ ਸਾਰਾ ਪੋਸੀਬਲ ਹੋਇਆ ਹੈ ਆਈ ਟੀ ਸੈਕਟਰ ਕਰਕੇ ਕਿਉਂਕਿ ਟੈਕਨੋਲਜੀ ਐਨੀ ਵੱਧ ਗਈ ਹੈ ਅਤੇ ਸਾਨੂੰ ਘਰ ਬੈਠੇ ਹੀ ਸਭ ਸਹੂਲਤ ਮਿਲ ਰਹੀ ਹੈ ਹੁਣ ਜੇਕਰ ਅਸੀਂ ਕੰਮ ਦੀ ਗੱਲ ਕਰੀਏ ਵਰਕ ਦੀ ਗੱਲ ਕਰੀਏ ਤਾਂ ਸਾਨ ਅਸੀਂ ਘਰ ਬੈਠ ਕੇ ਵੀ ਅਸੀਂ ਵਰਕ ਕਰ ਸਕਦੇ ਹਾਂ ਜਿੱਦਾਂ ਕਿ ਕੋਵਿਡ ਨਾਈਨਟੀਨ 'ਚ ਦੇਖਿਆ ਹੀ ਹੈ ਲੋਕਾਂ ਨੇ ਘਰ ਤੋਂ ਬੈਠ ਕੇ ਹੀ ਕੰਮ ਕਰਿਆ ਅਤੇ ਉਨ੍ਹਾਂ ਨੂੰ ਇਨਕਮ ਮਿਲ ਰਹੀ ਸੀਗੀ ਏ ਪਰ ਜੇ ਪਿਛਲੇ ਸਮੇਂ 'ਚ ਦੇਖੀਏ ਤਾਂ ਏਦਾਂ ਦਾ ਕੁਛ ਵੀ ਨਹੀਂ ਹੁੰਦਾ ਸੀਗਾ ਪਰ ਹੁਣ ਸੰਸਾਰ ਕਾਫੀ ਵਿਕਸਤ ਹੋ ਚੁੱਕਾ ਹੈ ਆਪਾਂ ਜੇਕਰ ਖਰੀਦਦਾਰੀ ਦੀ ਗੱਲ ਕਰੀਏ ਤਾਂ ਖਰੀਦਦਾਰੀ ਆਪਾਂ ਕਿੰਨੀਆਂ ਹੀ ਸਾਈਟਾਂ ਹਨ ਜਿਸ 'ਤੇ ਆਪਾਂ ਜਾ ਕੇ ਔਨਲਾਈਨ ਖਰੀਦ ਕਰ ਸਕਦੇ ਹਾਂ ਆਪਾਂ ਨੂੰ ਘਰ ਬੈਠੇ ਹੀ ਸਭ ਕੁਛ ਮਿਲ ਜਾਂਦਾ ਹੈ ਅਤੇ ਵਿਕਾਸਸ਼ੀਲਤਾ ਦੇ ਨਾਲ ਜੇ ਆਪਾਂ ਦੇਖੀਏ ਤਾਂ ਜਿੰਨਾ ਸੰਸਾਰ ਵਿਕਸਤ ਹੋ ਰਿਹਾ ਹੈ ਤਾਂ ਓਨੇ ਖਤਰੇ ਵੀ ਵੱਧ ਰਹੇ ਹਨ ਕਿਉਂਕਿ ਅੱਜ ਕੱਲ੍ਹ ਪਹਿਲਾਂ ਕਿਸੇ ਨੂੰ ਨਿਊਕਲ ਦਾ ਨਿਊਕਲੀਅਰ ਬਾਰੇ ਤਾਂ ਪਤਾ ਹੀ ਨਹੀਂ ਹੁੰਦਾ ਸੀਗਾ ਅਤੇ ਹੁਣ ਅੱਜ ਕੱਲ੍ਹ ਨਿਊਕਲੀਅਰ ਬੰਬ ਬਣ ਗਏ ਹਨ ਜਿਨ੍ਹਾਂ ਨਾਲ ਇੱਕ ਵਾਰ 'ਚ ਹੀ ਪਤਾ ਨਹੀਂ ਕਿੰਨੇ ਹੀ ਲੋਕਾਂ ਦੀ ਮੌਤ ਹੋ ਸਕਦੀ ਹੈ ਵਿਕਸਤ ਹੋਇਆ ਹੈ ਉਹਦੇ ਫਾਇਦੇ ਵੀ ਆ ਪਰ ਕੁਛ ਨੁਕਸਾਨ ਵੀ ਹੋਏ ਹਨ